ਹੈਲੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਇੰਦੂ ਬਾਲਾ ਹੈ ਮੈੇਨੇ ਜੀ ਅੱਜ ਸਵੀਗੀ ਤੋਂ ਇੱਕ ਪੀਜ਼ਾ ਅਤੇ ਬਰਗਰ ਆਰਡਰ ਕੀਤਾ ਸੀ ਮੇਰਾ ਆਰਡਰ ਨੰਬਰ ਇੱਕ ਸੌ ਦੋ ਸੀ ਪਰ ਜੋ ਡਿਲੀਵਰੀ ਵਾਲਾ ਆਇਆ ਸੀ ਨਾ ਜੀ ਉਹ ਬਹੁਤ ਬਦਤਮੀਜ਼ ਸੀ ਜੀ ਉਸਨੇ ਸਾਨੂੰ ਗਲਤ ਆਰਡਰ ਤਾਂ ਦਿੱਤੇ ਹੀ ਅਤੇ ਜਦੋਂ ਅਸੀਂ ਉਹਨੂੰ ਵਾਪਿਸ ਕ ਲੈਣ ਲਈ ਕਿਹਾ ਤਾਂ ਸਾਡੇ ਨਾਲ ਜੀ ਬੜੀ ਬਦਤਮੀਜ਼ੀ ਗੱਲ ਨਾਲ ਗੱਲ ਕਰ ਰਿਹਾ ਸੀ ਉਹ ਆਪਣੀ ਗਲਤੀ ਮੰਨਣ ਦੀ ਤਾਂ ਜੀ ਥਾਂ ਛੱਡੋ ਜੀ ਝਗੜਾ ਕਰ ਰਿਹਾ ਸੀ ਸਾਡੇ ਨਾਲ ਅਤੇ ਉਹ ਇੰਨੀ ਉੱਚੀ ਆਵਾਜ਼ ਵਿੱਚ ਗੱਲ ਕਰ ਰਿਹਾ ਸੀ ਜੀ ਕਿ ਮੇਰੇ ਮੰਮੀ ਅਤੇ ਪਾਪਾ ਵੀ ਬਾਹਰ ਆ ਗਏ ਉਹਨਾਂ ਨੇ ਵੀ ਉਹਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਜੀ ਉਹਨਾਂ ਨਾਲ ਵੀ ਬਹੁਤ ਬੁਰੇ ਤਰੀਕੇ ਨਾਲ ਗੱਲ ਕੀਤੀ ਜੀ ਉਹਨੇ ਅਸੀਂ ਉਸ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸਮਝ ਹੀ ਨਹੀਂ ਰਿਹਾ ਸੀ ਜੀ ਬਹੁਤ ਅਣਉਚਿਤ ਢੰਗ ਨਾਲ ਗੱਲ ਕਰ ਰਿਹਾ ਸੀ ਸਾਡੇ ਨਾਲ ਅਸੀਂ ਉਸ ਨੂੰ ਇਸ ਦੀ ਸ਼ਿਕਾਇਤ ਕਰਨ ਦੀ ਵੀ ਗੱਲ ਕੀਤੀ ਜੀ ਪਰ ਉਹਨੂੰ ਕਿਸੇ ਦਾ ਡਰ ਹੀ ਨਹੀਂ ਸੀ ਉਹ ਕਹਿੰਦਾ ਕੋਈ ਗੱਲ ਨਹੀਂ ਜੀ ਕਿਸੇ ਮਰਜ਼ੀ ਨੂੰ ਕਰ ਦਿਓ ਉਸ ਨੂੰ ਉਸ ਦੇ ਵਿਵਹਾਰ ਵਿੱਚ ਫਿਰ ਵੀ ਕੋਈ ਫਰਕ ਨਹੀਂ ਪਿਆ ਜੀ ਉਹ ਤਾਂ ਸਾਨੂੰ ਸਮਾ ਲਈ ਧਮਕੀਆਂ ਦੇ ਰਿਹਾ ਸੀ ਜੀ ਅਸੀਂ ਬਹੁਤ ਸ਼ਾਂਤੀ ਨਾਲ ਉਹਨੂੰ ਗੱਲ ਕੀਤੀ ਬਹੁਤ ਸ਼ ਜਾ ਬਹੁਤ ਸ਼ਾਂਤੀ ਨਾਲ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਆਪਣੀ ਗਲਤੀ ਮੰਨ ਲਵੇ ਅਤੇ ਮਤਲਬ ਇਹ ਵਾਪਿਸ ਲੈ ਜੇ ਔਡਰ ਜੀ ਔਰ ਉਹ ਮੰਨ ਹੀ ਨਹੀਂ ਰਿਹਾ ਸੀ ਉਹ ਤਾਂ ਸਗੋਂ ਸਾਨੂੰ ਕਹਿ ਰਿਹਾ ਸੀ ਕਿ ਤੁਹਾਡੀ ਗਲਤੀ ਹੈ ਤੁਸੀਂ ਗਲਤ ਔਡਰ ਕੀਤਾ ਹੈਗਾ ਜੀ ਅਸੀਂ ਉਸਨੂੰ ਬਹੁਤ ਬਹੁਤ ਬਹੁਤ ਜ਼ਿਆਦਾ ਸਮਝਾਇਆ ਜੀ ਪਰ ਉਸਨੇ ਤ ਉਹ ਤਾਂ ਝਗੜੇ 'ਤੇ ਆ ਗਿਆ ਸੀ ਜੀ ਉਹ ਤਾਂ ਲੜਾਈ ਝਗੜਾ ਕਰਨ ਲਈ ਵੀ ਤਿਆਰ ਸੀ ਜੀ ਇਸ ਲਈ ਜੀ ਸਾਨੂੰ ਜੀ ਮਜ਼ਬੂਰੀ 'ਚ ਉਸਦੀ ਸ਼ਿਕਾਇਤ ਤੁਹਾਨੂੰ ਕਰਨੀ ਪਈ ਜੀ ਸਾਡੀ ਬੇਨਤੀ ਆ ਜੀ ਕਿ ਇਸ ਤਰ੍ਹਾਂ ਦੇ ਵਿਵਹਾਰ ਕਰਨ ਵਾਲੇ 'ਤੇ ਜੀ ਸਖ਼ਤ ਐਕਸ਼ਨ ਲਿੱਤਾ ਜਾਵੇ ਜੀ